ਹੈਲੋ ਮੈਂ ਸੰਜਨਾ ਮੈਂ ਤੁਹਾਨੂੰ ਮਸ਼ਹੂਰ ਭਾਰਤ ਵਿਗਿਆਨੀ ਅਤੇ ਭਾਰਤ ਗਣਿਤ ਸ਼ਾਸਤਰ ਬਾਰੇ ਦੱਸਣਾ ਚਾਹੁੰਦੀ ਹਾਂ ਸਾਡੇ ਮਸ਼ਹੂਰ ਭਾਰਤ ਵਿਗਿਆਨੀ ਅਤੇ ਗਣਿਤ ਸ਼ਾਸਤ੍ਰੀਆਂ ਨੂੰ ਜੋੜ ਕੇ ਹੀ ਸਾਡੇ ਜਿਹੜੇ ਰੋਕਟ ਲੋਚ ਹੁੰਦੇ ਹਾਂ ਉਹ ਇਹਨਾਂ ਵਿਗਿਆਨ ਸਾਡੇ ਜਿਹੜੇ ਵਿਗਿਆਨੀ ਸ ਹੈਗੇ ਹਾਂ ਇਹਨਾਂ ਨੂੰ ਜੋੜ ਕੇ ਹੀ ਇੱਕ ਹ ਵਧੀਆ ਤੋਂ ਵਧੀਆ ਲੋਕ ਹ ਰੋਕਟ ਲਾਂਚ ਕਰਦੇ ਹਾਂ ਇਹਨਾਂ ਦੇ ਗਣਿਤ ਔਰ ਵਿਗਿਆਨ ਨੂੰ ਜੋੜ ਕੇ ਹੀ ਸਾਡੇ ਮਤਲਬ ਜਿਹੜੇ ਟ੍ਰੇਨ ਦੀਆਂ ਹੋ ਗਈਆਂ ਇੰਜਣਾਂ ਵਗੈਰਾ ਹੋ ਗਈਆਂ ਪਟੜੀਆਂ ਵਗੈਰਾ ਉਹਨਾਂ ਦੇ ਗੈਪ ਕਿਵੇਂ ਕਿਆ ਬਣਾਉਣੇ ਆ ਕਿੱਦਾਂ ਬਣਾਉਣੇ ਇਹ ਸਾਡੇ ਸਾਇੰਸ ਇਹਨਾਂ ਗਣਿਤ ਔਰ ਵਿਗਿਆਨ ਨੂੰ ਹੀ ਜੋੜ ਕੇ ਬਣਾਉਂਦੇ ਹਾਂ ਅਤੇ ਇਹਨਾਂ ਦੇ ਹੀ ਸਾਰੇ ਇਫੈਕਟਸ ਵਗੈਰਾ ਲੱਗਦੇ ਆ ਅਤੇ ਸਾਡੇ ਹੈਰੀਕੋਪਰਸ ਵਗੈਰਾ ਹੋ ਗਏ ਇਹਨਾਂ ਦੇ ਇੰਜਨ ਵਗੈਰਾ ਹੋ ਗਿਆ ਸਾਰਾ ਕੁਛ ਇਹਨਾਂ ਦੇ ਹਿਸਾਬ ਨਾਲ ਹੀ ਬਣਦਾ ਹੈਗਾ ਗਣਿਤ ਦੇ ਸਾਰਾ ਕੁਛ ਗਣਿਤ ਦੇ ਹਿਸਾਬ ਨਾਲ ਹੈ ਹੁੰਦਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਹੁਣ ਤਿੰਨ ਤਿੰਨ ਕੁ ਮੰਨਥ ਪਹਿਲਾਂ ਹੀ ਸਾਡੇ ਉਹ ਲਾਂਚ ਰੋਕਟ ਲਾਂਚ ਹੋਇਆ ਸੀਗਾ ਚੰਦਰਯਾਨ ਥ੍ਰੀ ਲਾਂਚ ਹੋਇਆ ਸੀਗਾ ਇਹ ਸਾਡੇ ਸਾਰੇ ਵਿਗਿਆਨ ਨੇ ਹੀ ਇਹਨਾਂ ਵਿੱਚ ਸਾਇੰਸ ਅਤੇ ਗਣਿਤ ਦਾ ਹੀ ਕਿਰਦਾਰ ਹੁੰਦਾ ਹੈ ਸਾਰਾ ਕੁਛ ਹੀ ਜੇ ਵਿਗਿਆਨ ਨੂੰ ਗਣਿਤ ਅਤੇ ਸਾਈ ਗਣਿਤ ਅਤੇ ਸਾਇੰਸ ਦਾ ਹੀ ਨਾ ਕੁਛ ਪਤਾ ਹੋਵੇ ਤੇ ਸਾਨੂੰ ਇਹਨਾਂ ਦਾ ਕੁਛ ਪਤਾ ਨਾ ਲੱਗੇ ਧਰਤੀ ਅਤੇ ਆਸਮਾਨਾਂ ਦਾ ਸਾਨੂੰ ਕੁਛ ਪਤਾ ਨਾ ਲੱਗੇ ਕਿ ਸਾਡੇ ਚਾਂਦ ਅਤੇ ਹੋਰ ਕੁਛ ਕਿਆ ਕੁਛ ਹੁੰਦਾ ਪਿਆ ਹੈ ਸਾਨੂੰ ਇਹਨਾਂ ਦੇ ਬਾਰੇ ਕੁਛ ਨਾ ਪਤਾ ਲੱਗੇ ਸਾਨੂੰ ਜੇ ਗਣਿਤ ਅਤੇ ਵਿਗਿਆਨ ਦਾ ਸਾਨੂੰ ਨੌਲੇਜ ਹੀ ਨਹੀਂ ਹੋਊਗਾ ਇਸ ਲਈ ਕਹਿੰਦੇ ਗਣਿਤ ਅਤੇ ਵਿਗਿਆਨ ਦਾ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਨੌਲੇਜ ਹੋਣੀ ਚਾਹੀਦੀ ਹੈ ਤਾਂ ਕਿ ਸਾਨੂੰ ਅੱਗੇ ਤੋਂ ਅੱਗੇ ਇਹਨਾਂ ਦੇ ਬਾਰੇ ਜਾਣਕਾਰੀ ਮਿਲਦੀ ਰਹੇ